ਪੰਜਾਬ ਦੀਆਂ ਖੇਡਾਂ ਦਾ ਘੇਰਾ ਬਹੁਤ ਵਿਸ਼ਾਲ ਹੈ ਆਧੁਨਿਕ ਖੇਡਾਂ ਵਿੱਚ ਹਾਕੀ ਅਤੇ ਕ੍ਰਿਕਟ ਅਤੇ ਹੋਰ ਬਹੁਤ ਸਾਰੀਆਂ ਪਰੰਪਰਿਕ ਖੇਡਾਂ ਹਨ ਜਿਵੇਂ ਕਬੱਡੀ ਕੁਸ਼ਤੀ ਖੋ ਖੋ ਪੰਜਾਬ ਦੀਆਂ ਸੌ ਤੋਂ ਵੱਧ ਰਿਵਾਇਤੀ ਖੇਡਾਂ ਹਨ ਪੰਜਾਬ ਦੀਆਂ ਰਿਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਨੇ ਦੋ ਹਜ਼ਾਰ ਚੋਦਾਂ ਤੋਂ ਪੰਜਾਬੀ ਦਿਹਾਤੀ ਖੇਡਾਂ ਵਿੱਚੋਂ ਕਬੱਡੀ ਕੁਸ਼ਤੀ ਨੂੰ ਰਾਜ ਪੱਧਰ 'ਤੇ ਰਾਸ਼ਟਰੀ ਪੱਧਰ 'ਤੇ ਅੰਤਰਰਾਸ਼ਟਰੀ ਪੱਧਰ ਉੱਪਰ ਵੀ ਮਾਨਤਾ ਮਿਲੀ ਹੈ ਕ੍ਰਿਕਟ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਹੈ ਇਸ ਖੇਡ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਬਣਾਈ ਗਈ ਹੈ ਕਿੰਗਜ਼ ਇਲੈਵਨ ਪੰਜਾਬ ਇੱਕ ਮਹੌਲੀ ਪੰਜਾਬ ਵਿੱਚ ਅਧਾਰਿਤ ਇੱਕ ਫਰੈਂਚਾਈਜ਼ ਕ੍ਰਿਕਟ ਟੀਮ ਹੈ ਜੋ ਕਿ ਲੋਕਾਂ ਨੂੰ ਆਪਸ ਵਿੱਚ ਬੰਨਦਾ ਹੈ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਪ੍ਰਗਟ ਕਰਦਾ ਹੈ ਖੇਡਾਂ ਵਿੱਚ ਭਾਗ ਲੈਣ ਦੇ ਨਾਲ ਇੱਕ ਇੱਕ ਇਨਸਾਨ ਆਪਣਾ ਆਪਣੀ ਸਮਾਜਿਕ ਪਛਾਣ ਬਣਾਉਂਦਾ ਹੈ ਅਤੇ ਇੱਕ ਸਮਾਜਿਕ ਪਛਾਣ ਆਤਮ ਵਿਸ਼ਵਾਸ ਲੋਕਾਂ ਦੇ ਨਾਲ ਮਿਲਣ ਵਰਤਣ ਅਤੇ ਅਭਿਆਸ ਨਾਲ ਬਣਦੀ ਹੈ ਰਾਸ਼ਟਰਵਾਦ ਅਤੇ ਖੇਡ ਆਪਸ ਵਿੱਚ ਜੁੜਿਆ ਹੋਇਆ ਹੈ ਖੇਡਾਂ ਅਲੱਗ ਅਲੱਗ ਕੌਮਾਂ ਵਿੱਚ ਮੁਕਾਬਲੇ ਦੇ ਸਥਾਨ ਪ੍ਰਦਾਨ ਕਰਦੀਆਂ ਹਨ ਪੰਜਾਬ ਦੀ ਸਭ ਤੋਂ ਮੁੱਖ ਖੇਡ ਕਬੱਡੀ ਹੈ ਕਬੱਡੀ ਸਾਡੀ ਮਾਂ ਖੇਡ ਹੈ ਅਤੇ ਇਹ ਸਿਰਫ਼ ਪੰਜਾਬ ਵਿਚ ਹੀ ਨਹੀਂ ਖੇਡੀ ਜਾਂਦੀ ਇਹ ਦੂਸਰੇ ਦੇਸ਼ਾਂ ਵਿੱਚ ਵੀ ਖੇਡੀ ਜਾਂਦੀ ਹੈ ਕਿਹਾ ਜਾਂਦਾ ਹੈ ਕਬੱਡੀ ਵੈਦਿਕ ਕਾਲ ਤੋਂ ਚੱਲਦੀ ਆ ਰਹੀ ਹੈ ਅਤੇ ਇਹ ਬਹੁਤ ਹੀ ਪੁਰਾਣੀ ਖੇਡ ਹੈ ਬਹੁਤ ਹੀ ਪੁਰਾਣੇ ਸਮੇਂ ਤੋਂ ਕਬੱਡੀ ਸਾਡੇ ਪੰਜਾਬ ਵਿੱਚ ਖੇਡੀ ਜਾ ਰਹੀ ਹੈ ਪੰਜਾਬੀਆਂ ਤੋਂ ਇਲਾਵਾ ਹੁਣ ਹਿੰਦੂ ਅੰਗਰੇਜ਼ ਮੁਸਲਮਾਨ ਆਦਿ ਵੀ ਕਬੱਡੀ ਨੂੰ ਖੇਡਦੇ ਹਨ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਹਾਕੀ ਵੀ ਇੱਕ ਬਹੁਤ ਵਧੀਆ ਖੇਡ ਹੈ ਹਾਕੀ ਦਾ ਮੈਚ ਵੀ ਬਹੁਤ ਦਿਲਚਸਪ ਹੁੰਦਾ ਹੈ ਅਤੇ ਪੰਜਾਬ ਦੇ ਬਹੁਤ ਸਾਰੇ ਖਿਡਾਰੀਆਂ ਨੇ ਹਾਕੀ ਵਿੱਚੋਂ ਟਰਾਫੀਆਂ ਅਤੇ ਮੈਡਲ ਜਿੱਤੇ ਹਨ ਇਸ ਤੋਂ ਇਲਾਵਾ ਵੀ ਬਹੁਤ ਖੇਡਾਂ ਹਨ ਜਿਵੇਂ ਖੋ ਖੋ ਬੈਡਮਿੰਟਨ ਫੁੱਟਬਾਲ ਆਦਿ ਜੋ ਕਿ ਪੂਰੇ ਸਮਾਜਿਕ ਤੌਰ 'ਤੇ ਖੇਡੀਆਂ ਜਾਂਦੀਆਂ ਹਨ ਅੰਤ ਵਿਚ ਮੈਂ ਤਾਂ ਇਹ ਹੀ ਕਹਾਂ ਕਹਿਣਾ ਚਾਹੁੰਦੀ ਹਾਂ ਕਿ ਖੇਡਾਂ ਰਾਸ਼ਟਰੀ ਜਾਂ ਸੱਭਿਆਚਾਰਕ ਭੈਅ ਭਾਵਨਾਵਾਂ ਨੂੰ ਪੈਦਾ ਕਰਦੀਆਂ ਹਨ ਧੰਨਵਾਦ